ਰੋਪੜ ਵਿੱਚ ਬਹੁਤ ਬਹੁਤ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚ ਬਸੰਤ ਪੰਚਮੀ ਲੋਹੜੀ ਵਿਸਾਖੀ ਹੋਲੀ ਦੁਸਹਿਰਾ ਅਤੇ ਗੁਰਪੁਰਬ ਹਨ ਬਸੰਤ ਪੰਚਮੀ ਬਸੰਤ ਪੰਚਮੀ ਦਾ ਬੱਚਿਆਂ ਨੂੰ ਬਹੁਤ ਚਾਅ ਹੁੰਦਾ ਹੈ ਉਸ ਦਿਨ ਨਵੇਂ ਨਵੇਂ ਪਤੰਗ ਲਿਆਂਦੇ ਜਾਂਦੇ ਹਨ ਆਪਣੇ ਛੱਤਾਂ ਵਗੈਰਾ 'ਤੇ ਡੀ ਜੇ ਲਗਾਏ ਜਾਂਦੇ ਹਨ ਅਤੇ ਬਹੁਤ ਰੋਲ਼ਾ ਪਾਇਆ ਜਾਂਦਾ ਹੈ ਖੱਪਖਾਨਾ ਕੀਤਾ ਜਾਂਦਾ ਹੈ ਪਤੰਗ ਵੱਢੇ ਜਾਂਦੇ ਹਨ ਲੁੱਟੇ ਜਾਂਦੇ ਹਨ ਅਤੇ ਵਿਸਾਖੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਵਿਸਾਖੀ ਪੰਜਾਬ ਵਿੱਚ ਬਹੁਤ ਧੂਮਧਾਮ ਨਾਲ ਮਨਾਈ ਜਾਂਦੀ ਹੈ ਲੋਹੜੀ ਲੋਹੜੀ ਦਾ ਵੀ ਸਭ ਨੂੰ ਬਹੁਤ ਚਾਅ ਹੁੰਦਾ ਹੈ ਲੋਹੜੀ ਵਾਲੇ ਦਿਨ ਲੋਕ ਇੱਕ ਦੂਜੇ ਤੋਂ ਘਰ ਬੱਚੇ ਇਕੱਠੇ ਹੋ ਕੇ ਲੋਕਾਂ ਤੋਂ ਮੰਗਣ ਜਾਂਦੇ ਹਨ ਅਤੇ ਲੋਹੜੀ ਦੇ ਗੀਤ ਗਾਉਂਦੇ ਹਨ ਹੋਲੀ ਹੋਲੀ ਵਾਲੇ ਦਿਨ ਦਾ ਵੀ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ ਇਸ ਦਿਨ ਇੱਕ ਦੁਸਰੇ ਦੇ ਰੰਗ ਲਗਾ ਕੇ ਹੋਲੀ ਮਨਾਈ ਜਾਂਦੀ ਹੈ ਦੁਸਿਹਰਾ ਦੁਸਹਿਰੇ ਦੀਵਾਲੀ ਨੂੰ ਵੀ ਬਹੁਤ ਚਾਅ ਹੁੰਦਾ ਹੈ ਦੁਸਹਿਰੇ ਨੂੰ ਦੀਵਾਲੀ ਨੂੰ ਆਤਿਸ਼ਬਾਜ਼ੀ ਖਰੀਦੀ ਜਾਂਦੀ ਹੈ ਸੋਨਾ ਖਰੀਦਿਆ ਜਾਂਦਾ ਹੈ ਸੋਨਾ ਉਸ ਦਿਨ ਸਸਤਾ ਹੁੰਦਾ ਹੈ ਦੀਵਾਲੀ ਨੂੰ ਸ੍ਰੀ ਗੁਰੂ ਰਾਮ ਚੰਦਰ ਜੀ ਆਪਣੇ ਘਰੋਂ ਘਰ ਪਰਤੇ ਸੀ ਅਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਲੋਕਾਂ ਨੇ ਦੇਸੀ ਘਿਉ ਦੀ ਦੀਪਮਾਲਾ ਕੀਤੀ ਸੀ ਉਹਨਾਂ ਦੀ ਆਉਣ ਦੀ ਖੁਸ਼ੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ ਗੁਰਪੁਰਬ ਗੁਰਪੁਰਬ ਸਾਡੇ ਗੁਰੂਆਂ ਦੇ ਜਨਮ ਵਗੈਰਾ 'ਤੇ ਕੱਢਿਆ ਜਾਂਦਾ ਹੈ ਇਸ ਦਿਨ ਥਾਂ ਥਾਂ ਲੰਗਰ ਲਗਾਏ ਜਾਂਦੇ ਹਨ ਗੁਰਦੁਆਰਾ ਸਾਹਿਬ ਵੀ ਸਜਾਏ ਜਾਂਦੇ ਹਨ ਬਹੁਤ ਲੋਕ ਵੱਧ ਤੋਂ ਵੱਧ ਉਸ ਦਿਨ ਮੱਥੇ ਟੇਕਦੇ ਹਨ ਅਤੇ ਗੁਰਦੁਆਰਾ ਸਾਹਿਬ ਪਹੁੰਚਦੇ ਹਨ